ਪੰਜਾਬ ਦੇ ਵਿੱਚ ਸਾਰੀਆਂ ਭਾਸ਼ਾਵਾਂ ਜਿਹੜੀਆਂ ਸਕੂਲਾਂ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਨੇ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ ਹਿੰਦੀ ਵੀ ਪੜ੍ਹਾਈ ਜਾਂਦੀ ਹੈ ਅਤੇ ਇੰਗਲਿਸ਼ ਵੀ ਪੜ੍ਹਾਈ ਜਾਂਦੀ ਹੈ ਅਤੇ ਇਸ ਤਰੀਕੇ ਦੇ ਨਾਲ ਕਿਹੜਾ ਆਪਣਾ ਭਾਸ਼ਾਈ ਵਿਭਿੰਨਤਾ ਹੈ ਇਹਦਾ ਮੁੱਦਾ ਆਪਣੇ ਆਪ ਹੀ ਹੱਲ ਹੋ ਜਾਂਦਾ ਕਿਉਂਕਿ ਬੱਚਾ ਤਿੰਨੋ ਹੀ ਭਾਸ਼ਾਵਾਂ ਸਿੱਖ ਰਿਹਾ ਅਤੇ ਜਦੋਂ ਔਲ ਥਰੂ ਇੰਡੀਆ ਉਹ ਭਾਰਤ ਦੇ ਵਿੱਚ ਕਿਤੇ ਵੀ ਜਾਂਦਾ ਏ ਆ ਤਾਂ ਉਹ ਹਿੰਦੀ ਆ ਇੰਗਲਿਸ਼ ਦੀ ਮਦਦ ਦੇ ਨਾਲ ਆਪਣੇ ਜਿਹੜੇ ਵਿਚਾਰ ਹੈ ਉਹਨਾਂ ਨੂੰ ਐਕਸਪ੍ਰੈਸ ਕਰ ਸਕਦਾ ਹੈ ਇਸ ਕਰਕੇ ਪੰਜਾਬ ਦੇ ਵਿੱਚ ਵੈਸੇ ਵੀ ਇਹ ਨਹੀਂ ਹੈ ਕਿ ਸਿਰਫ ਪੰਜਾਬੀ ਹੀ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੈ ਉਹ ਵੀ ਸਿਰਫ ਪੰਜਾਬੀ ਹੀ ਕਰਾਏ ਜਾਂਦੇ ਹਨ ਹਰਿਆਣਵੀ ਹਿਮਾਚਲੀ ਸਾਰੇ ਤਰ੍ਹਾਂ ਦੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੈ ਉਹ ਬੱਚਿਆਂ ਨੂੰ ਕਰਵਾਏ ਜਾ